ਪੰਜ ਸਤੰਬਰ ਉੱਨੀ ਸੌ ਨੜਿਨਵੇਂ ਵੀਹ ਅਗਸਤ ਉੱਨੀ ਸੌ ਚੌਂਤੀ ਤੇਈ ਮਾਰਚ ਦੋ ਹਜ਼ਾਰ ਦੋ ਬਾਰਾਂ ਜੁਲਾਈ ਉੱਨੀ ਸੌ ਨੱਬੇ ਸਤਾਰਾਂ ਜਨਵਰੀ ਉੱਨੀ ਸੌ ਪਚਾਸੀ